ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਪਰ ਮੈਂ ਸਾਰੀਆਂ ਕਿਤਾਬਾਂ ਤਕਰੀਬਨ ਸਕੂਲ ਦੀ ਲਾਈਬ੍ਰੇਰੀ 'ਚੋਂ ਲੈ ਕੇ ਪੜ੍ਹਨਾ ਜ਼ਿਆਦਾ ਪਸੰਦ ਕਰਦੀ ਹਾਂ